ਇੱਕ ਜੀਰੋ ਨੌ ਸੱਤ ਜੀਰੋ ਚਾਰ ਜੀਰੋ ਦੋ ਪੰਜ ਜੀਰੋ ਇੱਕ ਜੀਰੋ ਨੌ ਨੌ ਪੰਜ ਦੋ ਜੀਰੋ ਜੀਰੋ ਸੱਤ ਪੰਜ ਸੱਤ ਛੇ ਚਾਰ ਸੱਤ ਨੌ ਪੰਜ